ਹੈਲੋ ਹਾਂਜੀ ਵੰਸ਼ਿਕਾ ਮੈਮ ਕਿਵੇਂ ਹੋ ਮੈਂ ਵੀ ਵਧੀਆ ਹੋਰ ਘਰ ਸਭ ਵਧੀਆ ਹਾਂਜੀ ਸਾਰੇ ਠੀਕ ਨੇ ਮੈਂ ਤੁਹਾਡੇ ਨਾਲ ਮਤਲਬ ਇਹ ਗੱਲ ਕਰਨੀ ਸੀ ਕਿ ਜਿਵੇਂ ਹੁਣ ਬਾਰਿਸ਼ ਜ਼ਿਆਦਾ ਹੋ ਰਹੀ ਹੈ ਤਾਂ ਵੀ ਸਕੂਲ 'ਚ ਛੁੱਟੀਆਂ ਹੋ ਚੁੱਕੀਆਂ ਨੇ ਅਤੇ ਬੱਚਿਆਂ ਦਾ ਜਿਵੇਂ ਸਟੱਡੀ ਲੋਸ ਕਾਫੀ ਹੋ ਰਿਹਾ ਸੀ ਉਹਨਾਂ ਦੇ ਸਿਲੇਬਸ ਨੂੰ ਕਿਵੇਂ ਕਵਰ ਕਰਨਾ ਉਹ ਕੋਈ ਡਿਸਕਸ਼ਨ ਕਰਨੀ ਸੀ ਤਾਂ ਤੁਸੀਂ ਦੱਸੋ ਮੈਨੂੰ ਕਿ ਆਪਾਂ ਕੀ ਕਰੀਏ ਹਾਂ ਮਤਲਬ ਦੋਨੋਂ ਹੀ ਚੀਜ਼ਾਂ ਠੀਕ ਨੇ ਵੀ ਆਪਾਂ ਬੱਚਿਆਂ ਨੂੰ ਸਿਲੇਬਸ ਕਵਰ ਕਰਾ ਕੇ ਵਰਕਸ਼ੀਟ ਬਣਾ ਲੈਂਦੇ ਹਾਂ ਅਤੇ ਬੱਚਿਆਂ ਦੀ ਔਨਲਾਈਨ ਕਲਾਸਿਜ ਲਾ ਲਈ ਕਿਉਂਕਿ ਜੇ ਆਪਾਂ ਨਹੀਂ ਕਰਾਂਗੇ ਤਾਂ ਫੇਰ ਬੱਚੇ ਸਾਰਾ ਕੁਛ ਭੁੱਲ ਜਾਣਗੇ ਹਾਂਜੀ ਤਾਂ ਫੇਰ ਹੋਰ ਹਾਂ ਉਹ ਮੈਂ ਮਤਲਬ ਬਣਾ ਲੂਗੀ ਟਾਈਮ ਟੇਬਲ ਅਤੇ ਮੈਂ ਫਾਰਵਰਡ ਕਰ ਦੂਗੀ ਉਸ ਹਿਸਾਬ ਨਾਲ ਤੁਸੀਂ ਗਰੁੱਪ 'ਚ ਪਾ ਦਿਉ ਅਤੇ ਆਪਾਂ ਉਸ ਹਿਸਾਬ ਨਾਲ ਕੱਲ੍ਹ ਤੋਂ ਹੀ ਬੱਚਿਆਂ ਦੀ ਔਨਲਾਈਨ ਕਲਾਸਿਸ ਸ਼ੁਰੂ ਕਰ ਦੇਵਾਂਗੇ ਹਾਂਜੀ ਅਤੇ ਹੋਰ ਮੈਂ ਤੁਹਾਨੂੰ ਮਤਲਬ ਸ਼ਾਮ ਨੂੰ ਸੈਂਡ ਕਰ ਦੂਗੀ ਸ਼ਾਮ ਤੱਕ ਰਾਤ ਤੱਕ ਮੋਸਟਲੀ ਸੈਂਡ ਕਰ ਦੂਗੀ ਤਾਂ ਵੇਖ ਲਉ ਕੱਲ੍ਹ ਨਹੀਂ ਪੋਸੀਬਲ ਤਾਂ ਆਪਾਂ ਪਰਸੋਂ ਸ਼ੁਰੂ ਕਰ ਲਵਾਂਗੇ ਕਲਾਸਿਸ ਹਾਂ ਇਹ ਵੀ ਦਿੱਕਤ ਆ ਤਾਂ ਠੀਕ ਹੈ ਪਹਿਲਾਂ ਆਪਾਂ ਨੋਟਸ ਵਗੈਰਾ ਪ੍ਰੀਪੇਅਰ ਕਰ ਲੈਂਦੇ ਹਾਂ ਫੇਰ ਆਪਾਂ ਬੱਚਿਆਂ ਨੂੰ ਸਡਿਊਲ ਵਗੈਰਾ ਸਾਰਾ ਕੁਛ ਦੇ ਦੇਵਾਂਗੇ ਅਤੇ ਫਿਰ ਆਪਾਂ ਕਲਾਸਿਸ ਸ਼ੁਰੂ ਕਰ ਲਵਾਂਗੇ ਹਾਂਜੀ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਕੈਪੇਬਲ ਹੋ ਪੋਸੀਬਲ ਹੈ ਵੀ ਤੁਸੀਂ ਜੇ ਕਰ ਸਕਦੇ ਹੋ ਪ੍ਰੀਪੇਅਰ ਹੁਣੇ ਤਾਂ ਕਰ ਲਿਓ ਫੇਰ ਆਪਾਂ ਕੱਲ੍ਹ ਹੀ ਕਲਾਸਿਜ ਸ਼ੁਰੂ ਕਰ ਦੇਵਾਂਗੇ ਬੱਚਿਆਂ ਲਈ ਵੀ ਵਧੀਆ ਹੋਊਗਾ ਉਹਨਾਂ ਦਾ ਸਿਲੇਬਸ ਪਿੱਛੇ ਨਹੀਂ ਰਹੇਗਾ ਅਤੇ ਪ੍ਰਿੰਸੀਪਲ ਮੈਮ ਨਾਲ ਵੀ ਆਪਾਂ ਡਿਸਕਸ਼ਨ ਕਰ ਲਈਏ ਪਹਿਲਾਂ